ਵਰਤਮਾਨ ਦੀ ਨੌਜਵਾਨ ਪੀੜ੍ਹੀ ਅੰਧ ਵਿਸ਼ਵਾਸਾਂ ਤੋਂ ਵਧੇਰੇ ਦੂਰ ਹੈ ਨੌਜਵਾਨ ਪੀੜ੍ਹੀ ਅੰਧ ਵਿਸ਼ਵਾਸਾਂ ਨੂੰ ਨਹੀਂ ਮੰਨਦੀ ਜਿਸ ਕਰਕੇ ਮੈਂ ਵੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੋਣ ਕਰਕੇ ਅੰਧ ਵਿਸ਼ਵਾਸਾਂ ਨੂੰ ਨਹੀਂ ਮੰਨਦਾ ਪਰ ਅਕਸਰ ਹੀ ਮੈਂ ਆਪਣੇ ਆਸੇ ਪਾਸੇ ਅੰਧ ਵਿਸ਼ਵਾਸਾਂ ਨੂੰ ਹੁੰਦੇ ਵੇਖਦਾ ਰਹਿੰਦਾ ਹਾਂ ਜਿਵੇਂ ਟੂਣੇ ਕਰਨੇ ਅਤੇ ਬੱਕਰੇ ਜਾਂ ਜੀਵਾਂ ਦੀ ਬਲੀ ਦੇਣਾ ਆਦਿ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ ਅੰਧ ਵਿਸ਼ਵਾਸਾਂ ਵਿੱਚ ਵਧੇਰੇ ਦੇਹਧਾਰੀ ਦੀ ਪੂਜਾ ਕਰਨੀ ਅਤੇ ਜਿਵੇਂ ਚੁਰਸਤੇ ਵਿੱਚ ਟੂਣਾ ਕਰਨਾ ਜਿਸ ਵਿੱਚ ਲੱਡੂ ਧਰਨੇ ਸ਼ਰਾਬ ਧਰਨੀ ਮੀਟ ਧਰਨਾ ਆਦਿ ਪ੍ਰਚੱਲਿਤ ਹੈ